ਵੈਸੇ ਤਾਂ ਸਾਡੇ ਪਿੰਡ ਜਾਂ ਸਾਡੇ ਖੇਤਰ ਦੇ ਵਿੱਚ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਜਗ੍ਹਾਵਾਂ ਹਨ ਜਿੱਥੇ ਕਿ ਲੋਕ ਆ ਕੇ ਘੁੰਮ ਫਿਰ ਸਕਦੇ ਹਨ ਅਤੇ ਆਪਣਾ ਟਾਈਮ ਸਪੈਂਡ ਕਰ ਸਕਦੇ ਹਨ ਪਰ ਫਿਰ ਵੀ ਬਹੁਤ ਹੀ ਕਈ ਜਗ੍ਹਾਵਾਂ ਦੇ ਉੱਤੇ ਕੁਝ ਕੁ ਸੁਧਾਰਾਂ ਦੀ ਲੋੜ ਹੈ ਜਿਵੇਂ ਕਿ ਬਹੁਤ ਸਾਰੇ ਪਾਰਕਾਂ ਦੇ ਵਿੱਚ ਗੰਦਗੀ ਹੁੰਦੀ ਹੈ ਜਿਸ ਨੂੰ ਲੈ ਕੇ ਸਰ ਜਿਸ ਨੂੰ ਲੈ ਕੇ ਸਰਕਾਰ ਜਾਂ ਪੰਚਾਇਤ ਨੂੰ ਇਸ ਚੀਜ਼ ਨੂੰ ਲੈ ਕੇ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਉਸ ਜਗ੍ਹਾ ਦੇ ਉੱਤੇ ਕੂੜਾਦਾਨ ਅਤੇ ਕੁਛ ਕੁ ਅਜਿਹੇ ਨਿਯਮਾਂ ਦੀ ਲੋੜ ਹੈ ਤਾਂ ਕਿ ਉੱਥੋਂ ਦੀ ਸਫਾਈ ਰੱਖੀ ਜਾ ਸਕੇ ਅਤੇ ਬਹੁਤ ਸਾਰੀਆਂ ਜਗ੍ਹਾਵਾਂ ਦੇ ਵਿੱਚ ਸੇਫਟੀ ਪਰਪਜ ਨੂੰ ਲੈ ਕੇ ਵੀ ਬਹੁਤ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਜਿਵੇਂ ਕਿ ਕਈ ਜਗ੍ਹਾ ਦੇ ਉੱਤੇ ਪਾਰਕ ਦੇ ਨਾਲ ਟੋਬੇ ਜਾਂ ਫਿਰ ਛੱਪੜ ਲੱਗਦੇ ਹਨ ਜਿਹੜੇ ਕਿ ਬ ਜਿ ਜਿਸ ਕਾਰਨ ਬੱਚਿਆਂ ਦਾ ਖੇਡਦੇ ਖੇਡਦੇ ਧਿਆਨ ਉੱ ਧਿਆਨ ਨਹੀਂ ਰਹਿੰਦਾ ਅਤੇ ਉਹ ਬਹੁਤ ਵਾਰੀ ਛੱਪੜ ਵੱਲ ਚਲੇ ਜਾਂਦੇ ਹਨ ਅਤੇ ਇੱਕ ਦੋ ਵਾਰ ਤਾਂ ਕਈ ਡਿੱਗ ਵੀ ਚੁੱਕੇ ਹਨ ਤਾਂ ਕਿ ਤਾਂ ਇਹ ਚੀਜ਼ ਦੀ ਇਸ ਨੂੰ ਦੇਖਦੇ ਹੋਏ ਮੈਂ ਚਾਹੁੰਦਾ ਹਾਂ ਕਿ ਆਪਣੀ ਪੰਚਾਇਤ ਨੂੰ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਥੇ ਰੈਲਿੰਗ ਕੀਤੀ ਜਾਵੇ ਜਾਂ ਫਿਰ ਕੁਛ ਕੁ ਇ ਇਹੋ ਜਿਹੀ ਸੇਫਟੀ ਸੇਫਟੀ ਵਾਲੀਆਂ ਚੀਜ਼ਾਂ ਲਾਈਆਂ ਜਾਣ ਤਾਂ ਕਿ ਕਿਸੇ ਨੂੰ ਨੁਕਸਾਨ ਨਾ ਪਹੁੰਚੇ ਅਤੇ ਲੋਕ ਆਪਣਾ ਵਧੀਆ ਸੈਰ ਸਪਾਟਾ ਕਰ ਸਕਣ ਅਤੇ ਚਾਰ ਮਿੰਟ ਉੱਥੇ ਬਹਿ ਕੇ ਆਪਣਾ ਟਾਈਮ ਸਪੈਂਡ ਕਰ ਸਕਣ